ਹੈਲੋ ਨਹੀਂ ਅਤੇ ਮੈਂ ਤੁਹਾਨੂੰ ਪੁੱਛਣਾ ਹੈਗਾ ਕਿ ਗਿੱਧੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਸਾਨੂੰ ਕਿਹੜੀ ਡਰੈੱਸ ਅੱਪ ਦੀ ਪਾ ਸਕਦੇ ਆਪਾਂ ਡਰੈੱਸ ਵਗੈਰਾ ਉਹਦੀ ਨੋਲੇਜ ਲੈਣੀ ਸੀ ਤੁਹਾਡੇ ਕੋਲੋਂ

ਠੀਕ ਹੈ ਮੈਂ ਬੱਸ ਇਹ ਹੀ ਪੁੱਛਣਾ ਹੈਗਾ ਕਿ ਮਤਲਬ ਵਧੀਆ ਮਟੀਰੀਅਲ ਹੋਵੇ ਅਤੇ ਜੂਐਲਰੀ ਵਗੈਰਾ ਦੀ ਉਹ ਤੁਸੀਂ ਦੱਸਤਾ ਹੈ ਅਤੇ ਮਤਲਬ ਮੈਮ ਉਹ ਤਰੀਕਾ ਪੁੱਛਣਾ ਹੈਗਾ ਕਿ ਕਿੱਦਾਂ ਵੀਅਰ ਕਰਨਾ ਹੈ ਜੋ ਸਾਨੂੰ ਮਤਲਬ ਅਟ੍ਰੈਕਟਿਵ ਲੱਗੇ ਦੇਖਣ 'ਚ ਓਕੇ ਮੈਮ ਠੀਕ ਹੈ ਮੈਮ ਓਕੇ ਮੈਮ ਥੈਂਕ ਯੂ